ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਸੀਮਾ ਦੇਵੀ ਸੁਜਾਨਪੁਰ ਤੋਂ ਬੋਲਦੀ ਹਾਂ ਅਤੇ ਪਹਿਲਾਂ ਕੁਛ ਦਿਨ ਪਹਿਲਾਂ ਮੈਂ ਆਪਣੀ ਬੇਟੀ ਦੇ ਘਰ ਜਾਣਾ ਸੀ ਥੋੜ੍ਹਾ ਜਿਹਾ ਆਪਾਂ ਫੰਕਸ਼ਨ ਸੀ ਅਤੇ ਮੈਂ ਇੱਥੋਂ ਮਤਲਬ ਕਿ ਜਲੰਧਰ ਤੋਂ ਕੈਬ ਕਰਵਾਈ ਸੀ ਕੈਬ ਕਰਵਾਈ ਸੀ ਅਤੇ ਬਹੁਤ ਵਧੀਆ ਸੀ ਸਾਰਾ ਸਿਸਟਮ ਜੋ ਵੀ ਹੈ ਵੀ ਅੱਛੀ ਗੱਡੀ ਮਤਲਬ ਕਿ ਜੋ ਗੱਡੀ ਗੱਡੀ ਵੀ ਤੁਹਾਡੀ ਵਧੀਆ ਸੀ ਅਤੇ ਮੇਰਾ ਸਫਰ ਵੀ ਬਹੁਤ ਵਧੀਆ ਨਿਕਲਿਆ ਅਤੇ ਮੈਂ ਆਪਣੀ ਬੇਟੀ ਦੇ ਘਰ ਜਾ ਵੀ ਆਈ ਅਤੇ ਆਉਂਦੇ ਹੋਏ ਕਿ ਮੈਂ ਜਦੋਂ ਵੀ ਸੁਜਾਨਪੁਰ ਉੱਤਰੀ ਅਤੇ ਮੇਰੀ ਗੱਡੀ ਤੁਹਾਡੀ ਕੈਬ ਵਿੱਚ ਮੇਰਾ ਬੈਗ ਰਹਿ ਗਿਆ ਅਤੇ ਮੈਂ ਮਤਲਬ ਕਿ ਇਸ ਕਰਕੇ ਤੁਹਾਨੂੰ ਕਾਲ ਕਰਦੀ ਹਾਂ ਕਿ ਉਸ ਡਰਾਈਵਰ ਨੂੰ ਕਾਲ ਕੀਤੀ ਜਾਏ ਜਾਂ ਮਤਲਬ ਕਿ ਮੇਰਾ ਬੈਗ ਸਹੀ ਸਲਾਮਤ ਮੇਰੇ ਕੋਲ ਪੁੱਜਿਆ ਜਾਏ ਕਿ ਮੇਰੇ ਮੋਬਾ ਮੇਰੇ ਬੈਗ ਵਿੱਚ ਬਹੁਤ ਜ਼ਿਆਦਾ ਕੀਮਤੀ ਸਮਾਨ ਸੀ ਅਤੇ ਮੈਨੂੰ ਬਹੁਤ ਜ਼ਿਆਦਾ ਪ੍ਰੇਸ਼ਾਨੀ ਹੋਈ ਅਤੇ ਜਦੋਂ ਮੈਂ ਮਤਲਬ ਕਿ ਸੁਜਾਨਪੁਰ ਉੱਤਰੀ ਤਾਂ ਮੇਰੇ ਕੋਲ ਘਰ ਵਾਪਸ ਜਾਣ ਵਾਸਤੇ ਕੋਈ ਕਰਾਇਆ ਵੀ ਨਹੀਂ ਸੀ ਅਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਦੀ ਹਾਂ ਕਿ ਕੈਫ ਵਾਲੇ ਡਰਾਈਵਰ ਨਾਲ ਕੋਂਟੈਕਟ ਕਰਕੇ ਕਿ ਮੇਰਾ ਜੋ ਵੀ ਸਮਾਨ ਕੀਮਤੀ ਅਤੇ ਮੇਰਾ ਮੈਨੂੰ ਮਿਲਿਆ ਦਿੱਤਾ ਜਾਵੇ ਅਤੇ ਕੈਫ ਦਾ ਨੰਬਰ ਇੱਕ ਸੌ ਅੱਠ ਸੀ ਅਤੇ ਮਤਲਬ ਕਿ ਡਰਾਈਵਰ ਦਾ ਨੰਬਰ ਜੋ ਵੀ ਸਤਾਰਾਂ ਅਠਾਰਾਂ ਵੀਹ ਸੀ ਅਤੇ ਕਿਰਪਾ ਕਰਕੇ ਮਤਲਬ ਕਿ ਮੇਰੇ ਤੁਹਾਡੀ ਕਿਰਪਾ ਕਰਕੇ ਮੈਨੂੰ ਮੇਰਾ ਬੈਕ ਵਾਪਸ ਦਿੱਤਾ ਜਾਵੇ ਅਤੇ ਮੈਨੂੰ ਘਰ ਜਾਣ ਲਈ ਕੋਈ ਪਰੇਸ਼ਾਨੀ ਨਾ ਹੋਏ ਅਤੇ ਔਰ ਤੁਹਾਡੀ ਕੈਫ ਮੈਨੂੰ ਬਹੁਤ ਪਸੰਦ ਆਈ ਕਿ ਜੋ ਵੀ ਸਫਾਈ ਦੀ ਅੱਛੀ ਸੀ ਔਰ ਡਰਾਈਵਰ ਨੇ ਵੀ ਬਹੁਤ ਵਧੀਆ ਚਲਾਈ ਅਤੇ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੋਈ ਬਸ ਕਿਰਪਾ ਕਰਕੇ ਮੈਨੂੰ ਇਹ ਥੋੜ੍ਹੀ ਸੀ ਪਰੇਸ਼ਾਨੀ ਹੋਈ ਕਿ ਮੇਰਾ ਬੈਗ ਉਸ ਮਤਲਬ ਕੈਬ ਵਿੱਚ ਰਹਿ ਗਿਆ ਕਿਰਪਾ ਕਰਕੇ ਮੇ ਰਾ ਬੈਗ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਜਾਵੇ ਧੰਨਵਾਦ ਸ਼ੁਕਰੀਆ